ਸਤਿ ਸ਼੍ਰੀ ਅਕਾਲ ਜੀ ਮੈਂ ਸਲੋਨੀ ਬੋਲ ਰਹੀ ਹਾਂ ਐਕਚੁਅਲੀ ਮੈਂ ਤੁਹਾਡੀ ਵੈੱਬਸਾਈਟ ਤੋਂ ਇੱਕ ਫੇਸ ਸਕ੍ਰੱਬ ਔਡਰ ਕੀਤਾ ਸੀ ਅਤੇ ਇਹ ਬਹੁਤ ਹੀ ਇਸਦੀ ਜਿਹੜੀ ਪੈਕਿੰਗ ਹੈ ਬਹੁਤ ਹੀ ਘਟੀਆ ਹੈ ਅਤੇ ਇਸ ਵਿੱਚ ਤਾਂ ਲਿਖਿਆ ਹੋਇਆ ਸੀ ਕਿ ਇਸ 'ਚ ਸੌ ਗ੍ਰਾਮ ਸਕ੍ਰੱਬ ਅਤੇ ਚਾਰ ਮਾਸਕ ਮਿਲਣਗੇ ਪਰ ਮੈਨੂੰ ਤਾਂ ਇਹ ਇਹ ਸਿਰਫ ਪੰਜਾਹ ਗ੍ਰਾਮ ਵੀ ਨਹੀ ਲੱਗ ਰਿਹਾ ਅਤੇ ਇਸ 'ਚ ਸਿਰਫ ਦੋ ਹੀ ਮਾਸਕ ਆਏ ਹਨ ਮੈਨੂੰ ਤਾਂ ਤੁਹਾਡੀ ਵੈੱਬਸਾਈਟ ਬਹੁਤ ਹੀ ਘਟੀਆ ਲੱਗ ਰਹੀ ਹੈ ਕਿ ਮੈਂ ਮੈਂ ਇੱਥੇ ਇਸ ਮੈਂ ਤਾਂ ਨਾਲ਼ੇ ਉਹ ਸਟ੍ਰੋਬੇਰੀ ਵਾਲ਼ਾ ਮੰਗਵਾਇਆ ਸੀ ਅਤੇ ਇਹ ਤਾਂ ਪ ਓਰੇਂਜ ਵਾਲ਼ਾ ਆ ਗਿਆ ਅਤੇ ਮੈਨੂੰ ਤਾਂ ਤੁਹਾਡੀ ਵੈੱਬਸਾਈਟ ਬਹੁਤ ਹੀ ਬਕਵਾਸ ਅਤੇ ਘਟੀਆ ਲੱਗ ਰਹੀ ਹੈ ਮੈਂ ਆਪਣੀ ਸਾਰੀਆਂ ਸਹੇਲੀਆਂ ਨੂੰ ਇਹ ਹੀ ਕਹਾਂਗੀ ਕਿ ਤੁਹਾਡੀ ਵੈੱਬਸਾਈਟ ਤੋਂ ਕੁਛ ਵੀ ਨਾ ਖਰੀਦਣ ਅਤੇ ਮੈਂ ਇਸ ਨੂੰ ਲਗਾਉਣ ਨਾਲ਼ ਮੇਰੇ ਸਾਰੇ ਫੇਸ 'ਤੇ ਪਿੰਪਲ ਹੀ ਪਿੰਪਲ ਅਤੇ ਸਾਰਾ ਸਕਿੰਨ ਡੱਲ ਹੋ ਗਈ ਆ ਅਤੇ ਅਤੇ ਮੈਂ ਇਹ ਹੀ ਚਾਹੁੰਦੀ ਹਾਂ ਕਿ ਤੁਹਾਡੀ ਵੈੱਬਸਾਈਟ 'ਤੇ ਕੋਈ ਵੀ ਸਮਾਨ ਨਾ ਖਰੀਦਣ ਅਤੇ ਇਹ ਮੈਂ ਆਪਣੀ ਸਾਰੀਆਂ ਸਹੇਲੀਆਂ ਨੂੰ ਇਹ ਦੱਸਾਂਗੀ ਕਿ ਤੁਹਾਡੀ ਵੈੱਬਸਾਈਟ ਬਹੁਤ ਹੀ ਬਕਵਾਸ ਹੈ ਘਟੀਆ ਹੈ ਕੋਈ ਵੀ ਸਮਾਨ ਇੱਥੋਂ ਨਾ ਖਰੀਦਿਆ ਜਾਵੇ ਅਤੇ ਇਹ ਤਾਂ ਸਮਾਨ ਸਾਰਾ ਹੀ ਗਲਤ ਦਿੰਦੇ ਹਨ ਅਤੇ ਇਸਨੁੂੰ ਬਹੁਤ ਹੀ ਬੇਕਾਰ ਤਰੀਕੇ ਅਤੇ ਇਹ ਪੈਕਿੰਗ ਕਰਦੇ ਹਨ ਅਤੇ ਨਾ ਹੀ ਇਹ ਸਰਵਿਸ ਅੱਛੀ ਤਰੀਕੇ 'ਤੇ ਕਰਦੇ ਹਨ ਬਸ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਵੈੱਬਸਾਈਟ 'ਤੇ ਪ੍ਰੋਡਕਟ ਆਪਣੇ ਆਪਣਾ ਪ੍ਰੋਡਕਟ ਤੁਸੀਂ ਵਾਪਿਸ ਲੈ ਜਾਉ ਅਤੇ ਮੇਰੇ ਮੈਨੂੰ ਪੈ ਪੈਸੇ ਆਪਣੇ ਮੇਰੇ ਵਾਪਿਸ ਦੇ ਜਾਣ